ਹੈਲੋ ਹਾਂਜੀ ਵੀਰੇ ਓਲਾ ਵਾਲਿਆਂ ਤੋਂ ਬੋਲਦੇ ਹੋ ਭਾਅ ਜੀ ਮੈਂ ਨਾ ਬੁਕਿੰਗ ਕਰਵਾਈ ਸੀਗੀ ਆਪਣੀ ਕੈਬ ਦੀ ਕੈਬ ਬੁਕਿੰਗ ਨੰਬਰ ਮੇਰਾ ਹੈਗਾ ਵਾ ਚਾਰ ਪੰਜ ਛੇ ਸੱਤ ਅੱਠ ਨੌਂ ਪੰਜ ਛੇ ਸੱਤ ਅੱਠ ਨੌਂ ਇਹ ਮੈਂ ਜਾਣਾ ਸੀਗਾ ਭਾਅ ਜੀ ਬਠਿੰਡੇ ਤੋਂ ਜਾਣਾ ਸੀ ਆਪਾਂ ਬਾਦਲ ਪਰ ਹੁਣ ਮੇਰੀ ਉਹ ਐਮਰਜੈਂਸੀ ਕੋਈ ਪੈ ਗਈ ਹੈ ਹੁਣ ਮੈਂ ਨਾ ਇਹ ਕੈਂਸਲ ਕਰਵਾਉਣੀ ਹੈ ਬੁਕਿੰਗ ਭਾਅ ਜੀ ਮੈਨੂੰ ਨਾ ਥੋੜ੍ਹਾ ਸੀਰੀਅਸਲੀ ਬੜਾ ਅਰਜੈਂਟ ਕੰਮ ਆ ਜੇਕਰ ਤੁਸੀਂ ਹੁਣ ਬੁਕਿੰਗ ਕੈਂਸਲ ਕਰ ਦੋਗੇ ਤਾਂ ਬਹੁਤ ਵਧੀਆ ਹੋਊਗਾ ਕਿਉਂਕਿ ਫਿਰ ਮੈਂ ਹੋਰ ਕਿਤੇ ਨਿਕਲਣਾ ਵਾ ਪਹਿਲਾਂ ਆਪਣਾ ਪਲਾਨ ਸੀਗਾ ਉੱਥੇ ਜਾਣ ਦਾ ਪਰ ਹੁਣ ਨਹੀਂ ਹੈਗਾ ਹੁਣ ਨਾ ਥੋੜ੍ਹੀ ਕਿਉਂ ਫੈਮਿਲੀ ਥੋੜ੍ਹੀ ਐਮਰਜੈਂਸੀ ਪੈ ਗਈ ਹੁਣ ਮੈਂ ਕਿਤੇ ਹੋਰ ਚੱਲਾ ਵਾ ਭਾਅ ਜੀ ਠੀਕ ਆ ਜੇਕਰ ਤੁਸੀਂ ਆਹ ਕੈਂਸਲ ਕਰ ਦੋਗੇ ਤਾਂ ਵਧੀਆ ਵਾ ਕਿਉਂਕਿ ਵਧੀਆ ਹੀ ਰਹਿਣਾ ਭਾਅ ਜੀ ਦੇਖੋ ਕਰ ਦੋਗੇ ਤਾਂ ਜ਼ਿਆਦਾ ਵਧੀਆ ਵਾ ਅਤੇ ਫਿਰ ਨਾਲ ਦੇ ਨਾਲ ਤੁਹਾਡੇ ਡਰਾਈਵਰ ਜੇਕਰ ਡਰਾਈਵਰ ਚੱਲ ਚੁੱਕਾ ਭਾਈ ਤਾਂ ਡਰਾਈਵਰ ਨੂੰ ਕਹਿ ਦੇਵੋ ਜਿਹੜਾ ਹੁਣ ਤੁਸੀਂ ਕੱਟਣਾ ਵਾ ਤਾਂ ਕੱਟ ਲਵੋ ਜਿਹੜੇ ਵੀ ਪੈਸੇ ਪੂਸੇ ਕੱਟਣੇ ਤੁਸੀਂ ਕੱਟ ਸਕਦੇ ਹੋ ਇੱਦਾਂ ਦੇ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਉਹੀ ਜਿੰਨਾ ਬਚ ਗਿਆ ਉਹਨਾਂ ਰਿਫੰਡ ਕਰ ਦਿਓ ਮੈਨੂੰ ਠੀਕ ਹੈ ਭਾਅ ਜੀ ਥੈਂਕ ਯੂ